ਹਾਂਜੀ ਨਮਸਕਾਰ ਜੀ ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਮੈਂ ਯੂਟੀਊਬ ਚੈਨਲ ਟੀ ਵੀ ਵਗੈਰਾ ਦੇਖਦੀ ਹਾਂ ਸਾਡੇ ਪੰਜਾਬ ਵਿੱਚ ਜ਼ਿਆਦਾਤਰ ਤਾਂ ਹੁਣ ਟੀ ਵੀ ਘੱਟ ਗਏ ਹਨ ਅਤੇ ਜ਼ਿਆਦਾ ਫੋਨ ਵਗੈਰਾ ਚੱਲ ਪਏ ਹਨ ਅਸੀਂ ਹੁਣ ਜ਼ਿਆਦਾਤਰ ਤਾਂ ਫੋਨ ਵਿੱਚ ਹੀ ਮੰਨੋਰੰਜਨ ਕਰਦੇ ਹਾਂ ਜਿਵੇਂ ਅਸੀਂ ਯੂਟੀਊਬ 'ਤੇ ਬੜਾ ਕੁਛ ਦੇਖਦੇ ਹਾਂ ਨਾਟਕ ਵਗੈਰਾ ਵੀ ਆਉਂਦੇ ਹੈ ਸਾਰਾ ਕੁਛ ਆਉਂਦਾ ਯੂਟੀਊਬ 'ਤੇ ਅਸੀਂ ਦੇਖਦੇ ਹਾਂ ਸਾਡੇ ਬੱਚੇ ਵੀ ਕਾਟੂਨ ਵਗੈਰਾ ਦੇਖਦੇ ਆ ਯੂਟੀਊਬ 'ਤੇ ਸਾਡੇ ਟੀਵੀ ਤਾਂ ਟੀ ਵੀ ਤਾਂ ਅਸੀਂ ਬਹੁਤ ਘੱਟ ਯੂਜ ਕਰਦੇ ਹਾਂ ਜ਼ਿਆਦਾਤਰ ਅਸੀਂ ਫੋਨ 'ਤੇ ਟਾਈਮ ਬਤੀਤ ਕਰਦੇ ਹਾਂ ਤਾਂ ਕਿ ਅਸੀਂ ਨਾਟਕ ਦੇਖੀਏ ਸਾਨੂੰ ਚਲੋ ਨਾਟਕ ਵਿੱਚ ਸਿੱਖ ਸਿੱਖਣ ਨੂੰ ਬੜਾ ਕੁਛ ਮਿਲਦਾ ਹੈ ਤਾਂ ਕਿ ਕੁਛ ਵੀ ਸਿੱਖ ਸਕੀਏ ਸਾਨੂੰ ਬੜੀਆਂ ਬੜਾ ਕੁਛ ਮਿਲਦਾ ਹੈ ਸਿੱਖਣ ਨੂੰ ਸਹੂਲਤਾਂ ਮਿਲਦੀਆਂ ਹਨ ਅਸੀਂ ਆਪਣਾ ਮੰਨੋਰੰਜਨ ਵੀ ਫੋਨ 'ਤੇ ਹੀ ਕਰਦੇ ਹਾਂ ਜਦੋਂ ਮਤਲਬ ਜਦੋਂ ਸਾਡੇ ਪੰਜਾਬ ਵਿੱਚ ਫੋਨ ਆ ਗਿਆ ਅਸੀਂ ਹੁਣ ਟੀ ਵੀ ਦੇਖਣਾ ਬਹੁਤ ਘੱਟ ਕਰਤਿਆ ਅਸੀਂ ਫੋਨ 'ਤੇ ਜ਼ਿਆਦਾ ਟਾਈਮ ਬਤੀਤ ਕਰਦੇ ਹਾਂ ਸਾਡੇ ਬੱਚੇ ਵੀ ਫੋਨ 'ਤੇ ਟੀ ਵੀ ਬਤੀਤ ਕਰਦੇ ਹੈ ਜੋ ਵੀ ਆ ਬੱਚੋ ਕਾ ਕਾਮ ਜੋ ਆਉਂਦਾ ਬੱਚੇ ਦਾ ਸਕੂਲ ਦਾ ਕੰਮ ਜ਼ਿਆਦਾ ਫੋਨ 'ਤੇ ਆਉਂਦਾ ਬੱਚੇ ਆਪਣਾ ਫੋਨ 'ਤੇ ਕੰਮ ਕਰਦੇ ਆ ਸਾਰਾ ਮਤਲਬ ਕਿ ਕਹਿਣ ਦਾ ਮਤਲਬ ਹਰ ਘਰ ਵਿੱਚ ਫੋਨ ਹੈ ਫੋਨ ਦਾ ਹੀ ਜ਼ਿਆਦਾ ਇਸਤੇਮਾਲ ਹੁੰਦਾ ਹੈ ਸਾਡੀ ਭਾਸ਼ਾ ਵੀ ਪੰਜਾਬੀ ਪੰਜਾਬੀ ਵਿੱਚ ਹੀ ਸਾ ਅਸੀਂ ਸਭ ਕੁਝ ਦੇਖਦੇ ਹਾਂ ਸਾਰਾ ਸਾਡਾ ਹੋਰ ਵੀ ਅਸੀਂ ਯੂਟੀਊਬ ਚੈਨਲ 'ਤੇ ਬੜਾ ਕੁਛ ਮਤਲਬ ਸਿੱਖਦੇ ਵੀ ਹਾਂ ਸਾਨੂੰ ਬਣਾਉਣਾ ਨਹੀਂ ਆਉਂਦਾ ਕੁਛ ਅਸੀਂ ਕੀ ਕਰਦੇ ਹਾਂ ਅਸੀਂ ਯੂਟੀਊਬ ਚੈਨਲ ਖੋਲ੍ਹ ਕੇ ਉਹਨਾਂ ਤੋਂ ਸਿੱਖਦੇ ਹਾਂ ਇਹਦੇ ਵਿੱਚ ਕੀ ਹੁੰਦਾ ਰੈਸਪੀ ਕਿਹੜੀ ਬਣਨੀ ਚਾਹੁੰਦੀ ਕਿੱਦਾਂ ਦੀ ਬਣਦੀ ਹੈ ਹਰ ਇੱਕ ਮਤਲਬ ਸਿੱਖਦੇ ਹਾਂ ਰੈਸਪੀ ਕਿੱਦਾਂ ਦੀ ਹੈ ਉਹ ਕੀ ਕਿੱਥੋਂ ਇੱਦਾਂ ਹੋ ਕੇ ਜਾਂ ਕਿੱਦਾਂ ਕੁਛ ਨਾ ਕੁਛ ਅਸੀਂ ਸਿੱਖਦੇ ਹੀ ਰਹਿੰਦੇ ਹਾਂ ਉਸ ਤੋਂ